ਪਿੰਡਾਂ ਵਿੱਚ ਖੇਡਾਂ ਖੇਡਣ ਨਾਲ ਸਾਡਾ ਵਿਕਸਿਤ ਸਰੀਰ ਬਹੁਤ ਹੀ ਤੰਦਰੁਸਤ ਰਹਿੰਦਾ ਹੈ ਅਤੇ ਮਨ ਨੂੰ ਸ਼ਾਤੀ ਮਿਲਦੀ ਹੈ ਅਤੇ ਬਹੁਤ ਹੀ ਵਧੀਆ ਸਰੀਰ ਬਣਾਉਣ ਨੂੰ ਮਿਲਦਾ ਹੈ